ਦੇਖੋ ਪੋਲਟਰੀ ਦਾ ਕਾਰੋਬਾਰ ਜਿਹੜਾ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਮੇਨ ਗੱਲ ਕੀ ਹੈ ਮੇਨ ਮਤਲਬ ਮੁੱਦਾ ਕਿ ਪੈਸਾ ਹਨਾ ਪੈਸਾ ਕਿੱਥੋਂ ਆਉਗਾ ਜੇ ਥੋੜਾ ਬਹੁਤਾ ਬੰਦਾ ਆਰੇਂਜ ਕਰ ਵੀ ਲੈਂਦਾ ਪਰ ਫਿਰ ਵੀ ਮਤਲਬ ਕਿ ਇਹਨਾਂ ਪੈਸਾ ਨੀਅਰ ਇੰਜ ਕਰ ਸਕਦਾ ਕਿ ਉਹ ਕੰਮ ਇਕੱਲਾ ਬੰਦਾ ਸ਼ੁਰੂ ਕਰ ਸਕੇ ਹੈਨਾ ਤੇ ਤੇ ਉਹਦੇ ਲਈ ਇੱਕ ਇੱਕ ਅੱਜ ਕੱਲ ਸਰਕਾਰ ਨੇ ਆਤਮ ਨਿਰਭਰ ਜਿਵੇਂ ਸਕੀਮ ਸ਼ੁਰੂ ਕੀਤੀ ਹੈ ਉਹਦੇ ਨਾਲ ਕੀ ਹੈ ਸਰਕਾਰ ਹੈਲਪ ਕਰ ਦਿੰਦੀ ਆ ਹਨਾ ਆਪਣਾ ਬਿਜਨਸ ਸ਼ੁਰੂ ਕਰਨ ਲਈ ਉਸ ਤੋਂ ਬਾਅਦ ਕੀ ਹੈ ਦੂਜੀ ਗੱਲ ਇਹ ਆ ਜਾਂਦੀ ਹੈ ਵੀ ਵੀ ਚਲੋ ਪੈਸਾ ਵੀ ਆ ਗਿਆ ਹਨਾ ਤੇ ਦੂਜੀ ਗੱਲ ਆਦੀ ਜਮੀਨ ਤੇ ਜਿਹੜੀ ਬੰਦੇ ਕੋਲ ਜਮੀਨ ਮਤਲਬ ਹੈ ਹਨਾ ਤੇ ਪੋਲਟਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਮਤਲਬ ਕਿ ਜਮੀਨ ਹੋਣੀ ਚਾਹੀਦੀ ਹੈ ਨਾ ਉਸ ਤੋਂ ਬਾਅਦ ਇਹ ਬੰਦਾ ਆਪਦਾ ਪੈਸਾ ਵਗੈਰਾ ਅਰੇਂਜ ਕਰਦਾ ਚਲੋ ਜਿਹੜੀ ਜਮੀਨ ਹੁੰਦੀ ਹੈ ਨਾ ਉਹ ਕੀ ਆ ਕਿ ਘੱਟੋ ਘੱਟ ਪਿੰਡ ਤੋਂ ਦੋ ਸੌ ਤਿੰਨ ਸੌ ਮੀਟਰ ਦੂਰੀ ਤੇ ਹੋਣੀ ਚਾਹੀਦੀ ਹੈ ਕਿਉਂਕਿ ਪੋਲਟਰੀ ਫੋਰਮ ਇੱਕ ਅਜਿਹਾ ਕਾਰੋਬਾਰੀ ਜਿਹਦੇ ਵਿੱਚ ਕਿ ਜਾਨਵਰ ਹੁੰਦੇ ਹਨਾ ਮੁਰਗੇ ਵਗੈਰਾ ਹੁੰਦੇ ਕਿ ਉਹਨਾਂ ਨਾਲ ਮਤਲਬ ਕਿ ਬਹੁਤ ਗੰਦੀ ਸਮੈਲ ਆਉਂਦੀ ਹੈ ਜਿਹੜੀ ਕਿ ਆਮ ਲੋਕਾਂ ਲਈ ਸਹਿਣੀ ਦਾ ਮਤਲਬ ਆਮ ਲੋਕਾਂ ਨੂੰ ਵਧੀਆ ਨਹੀਂ ਲੱਗਦੀ ਹਨਾ ਡੇਲੀ ਡੇਲੀ ਰੂਟੀਨ ਨੂੰ ਖਰਾਬ ਕਰਦੀ ਆ ਇਹਦੇ ਲਈ ਇੱਕ ਉਹ ਪਿੰਡ ਤੋਂ ਦੂਰ ਹੀ ਹੋਣੀ ਚਾਹੀਦੀ ਪਿੰਡ ਸ਼ਹਿਰ ਤੋਂ ਹਨਾ ਦੂਰ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਕਿ ਆ ਜਿਵੇਂ ਮਤਲਬ ਜਿਵੇਂ ਹੁਣ ਮਤਲਬ ਕਿ ਜਾਨਵਰਾਂ 'ਚ ਹਨਾ ਜਿਵੇਂ ਹੁਣ ਆਪਾਂ ਜਾਨਵਰ ਪਾਲੇ ਹੋਇਆ ਇਹ ਵੀ ਇੱਕ ਚੁਣੌਤੀ ਆ ਹਨਾ ਜਿਵੇਂ ਇੱਕ ਜਾਨਵਰ ਆਪਾਂ ਪਾਲੇ ਹੋਏ ਮੁਰਗੇ ਮੁਰਗੀਆਂ ਜੋ ਵੀ ਹਨਾ ਤੇ ਤੇ ਉਹਨਾਂ ਵਿੱਚੋਂ ਇਹ ਕਿਸੇ ਵੀ ਇੱਕ ਨੂੰ ਜੇ ਬਿਮਾਰੀ ਹੋਊਗੀ ਤਾਂ ਜਾਨਵਰਾਂ ਵਿੱਚ ਕਈ ਬਿਮਾਰੀਆਂ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਛੂਤ ਨਾਲ ਬਹੁਤ ਜਲਦੀ ਫੈਲ ਜਾਂਦੀਆਂ ਹਨਾ ਇਹਦੇ ਨਾਲ ਕੀ ਕਿ ਦੂਜੇ ਮੁਰਗੇ ਮੁਰਗਿਆਂ ਨੂੰ ਵੀ ਨੁਕਸਾਨ ਹੁੰਦਾ ਜਾ ਦੂਜੇ ਜਾਨਵਰਾਂ ਨੂੰ ਵੀ ਨੁਕਸਾਨ ਹੁੰਦਾ ਜੇਕਰ ਇੱਕ ਜਾਨਵਰ ਨੂੰ ਐਵੇਂ ਦੀ ਕੋਈ ਬਿਮਾਰੀ ਹੋ ਜਾਂਦੀ ਆ ਹਨਾ ਉਸ ਤੋਂ ਬਾਅਦ ਦੀ ਗੱਲ ਹੈ ਜਿਵੇਂ ਹੁਣ ਕਿ ਮਤਲਬ ਕਿ ਜਿਹੜਾ ਮੇਨ ਪਰਸਨ ਆ ਹਨਾ ਜਿੰਦਾ ਇਹ ਕਾਰਬਨ ਹੋਊਗਾ ਜੇ ਉਹਨੂੰ ਕੋਈ ਕੰਮ ਪੈ ਗਿਆ ਜਾਂ ਕੁਝ ਦਿਨਾਂ ਲਈ ਬਾਹਰ ਗਿਆ ਤੇ ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਬੰਦਾ ਪੋਲਟਰੀ ਫਾਰਮ ਕੱਲਾ ਮਤਲਬ ਮੇਰੇ ਹਿਸਾਬ ਨਾਲ ਤਾਂ ਨਹੀਂ ਖੋਲ ਸਕਦਾ ਉਹ ਹਮੇਸ਼ਾ ਪਾਰਟਨਰਸ਼ਿਪ 'ਚ ਖੋਲਦਾ ਪਰ ਦੂਜੀ ਗੱਲ ਜੇ ਮੰਨ ਲਓ ਖੋਲਦਾ ਵੀ ਹੈ ਪੋਲਟਰੀ ਫਾਰਮ ਆਪਦਾ ਤਾਂ ਉਹਦੇ ਕਿਉਂਕਿ ਉਹਨੇ ਆਪਦੇ ਹੇਠਾ ਵਰਕਰ ਰੱਖੇ ਹੁੰਦੇ ਆ ਠੀਕ ਹੈ ਤਾਂ ਜੇ ਉਹ ਕੁਝ ਦਿਨਾਂ ਲਈ ਬਾਹਰ ਜਾਂਦਾ ਵੀ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇਹਦੇ ਨੀਚੇ ਵਰਕਰ ਹੁੰਦੇ ਨੇ ਉਹ ਜਾਨਵਰਾਂ ਦੀ ਦੇਖਭਾਲ ਵਧੀਆ ਤਰੀਕੇ ਨਾਲ ਕਰ ਸਕਦੇ ਨੇ